ਦਸ ਫ਼ਰਵਰੀ ਦੋ ਹਜ਼ਾਰ ਪੰਦਰਾਂ ਅਗਸਤ ਦੋ ਹਜ਼ਾ ਹਜ਼ਾਰ ਉਨੀ ਅੱਠ ਸਪਤੰਬਰ ਦੋ ਹਜ਼ਾਰ ਇੱਕ ਸੱਤ ਦਸੰਬਰ ਦੋ ਹਜ਼ਾਰ ਬਾਈ ਇੱਕ ਜਨਵਰੀ ਦੋ ਹਜ਼ਾਰ ਪੰਦਰਾਂ